ਹਾਂ ਮੈਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਹੈ ਮੈਂ ਆਮ ਤੌਰ 'ਤੇ ਘੱਟ ਤੇਲ ਦਾ ਖਾਣਾ ਬਣਾਉਣਾ ਪਸੰਦ ਕਰਦੀ ਹਾਂ ਅਤੇ ਇਸ ਸਬੰਧੀ ਵੱਖੋ ਵੱਖ ਰੈਸਪੀਆਂ ਵੇਖਦੀ ਰਹਿੰਦੀ ਹਾਂ ਮੈਨੂੰ ਇੱਕ ਦਿਨ ਘੱਟ ਤੇਲ ਵਾਲੇ ਖਾਣੇ ਦੇਖਣ ਵਿੱਚ ਛੋਲੇ ਭਟੂਰੇ ਬਣਾਉਣੇ ਸਿਖਾਏ ਗਏ ਸਨ ਮੈਂ ਉਹ ਬਣਾਏ ਅਤੇ ਉਹਨਾਂ ਵਿੱਚ ਘੱਟ ਤੇਲ ਦੀ ਵਰਤੋਂ ਕਰਕੇ ਮੈਨੂੰ ਬਹੁਤ ਹੀ ਵਧੀਆ ਲੱਗਿਆ